ਅਸੀਂ ਜਦੋਂ ਮੰਡੀ ਵਿੱਚ ਆਪਣੇ ਖੇਤੀਬਾੜੀ ਉਤਪਾਦ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਪਹਿਲੀ ਗੱਲ ਆਵਾਜਾਈ ਦੇ ਸਾਧਨ ਬਹੁਤ ਘੱਟ ਹੈ ਜਿਸ ਵਿੱਚ ਅਸੀਂ ਢੋਆ ਢੁਆਈ ਵਾਸਤੇ ਸਾਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਕਿਸੇ ਨਾ ਕਿਸੇ ਤਰੀਕੇ ਅਸੀਂ ਮੰਡੀ ਚਲੇ ਵੀ ਗਏ ਤਾਂ ਉੱਥੇ ਸਾਨੂੰ ਹੋਰ ਵੀ ਬਹੁਤ ਦਿੱਕਤਾਂ ਆਉਂਦੀਆਂ ਜਿਸ ਤਰ੍ਹਾਂ ਕਿ ਉੱਥੋਂ ਰੇਟ ਨਹੀਂ ਸਹੀ ਮਿਲਣਾ ਸਾਨੂੰ ਆਪਣੇ ਉਤਪਾਦ ਦਾ ਖੇਤੀਬਾੜੀ ਦਾ ਰੇਟ ਸਹੀ ਢੰਗ ਨਾਲ਼ ਨਹੀਂ ਮਿਲਦਾ ਵਿੱਚ ਜੋ ਦਲਾਲ ਹੈ ਉਹ ਬਹੁਤ ਕੰਮ ਖਰਾਬ ਕਰਦੇ ਹੈ ਜੋ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਜਿਮੀਦਾਰਾਂ ਕਿੰਨੀ ਜਮ੍ਹਾਂ ਨਹੀਂ ਦੇਖਦੇ ਅਤੇ ਬਾਕੀ ਮੀਂਹ ਕਣੀ ਵਿੱਚ ਉਹ ਫਸਲ ਢੱਕਣ ਵਾਸਤੇ ਕੋਈ ਪੁਖਤਾ ਤਰਪਾਲਾਂ ਦਾ ਪ੍ਰਬੰਧ ਨਹੀਂ ਹੁੰਦਾ ਉੱਥੇ ਸਾਡੀ ਫਸਲ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਜਿਮੀਂਦਾਰ ਨੂੰ ਕਿਸਾਨ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ